ਲੱਕੜ ਦੀ ਜਗ੍ਹਾ ਹੁਣ ਐੱਲ ਪੀ ਜੀ ਸਿਲੰਡਰ ਨੇ ਲੈ ਲਈ ਹੈ ਇਹ ਹੁਣ ਹਰ ਘਰ ਵਿੱਚ ਮੌਜੂਦ ਹੈ ਇਸ ਨਾਲ ਬਹੁਤ ਜ਼ਿਆਦਾ ਫਾਇਦਾ ਹੋ ਚੁੱਕਾ ਹੈ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਇਸ ਨਾਲ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਦਾ ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਹੈਗਾ ਪਰ ਇਸ ਦੇ ਕੁਝ ਨੁਕਸਾਨ ਵੀ ਹਨ ਇਸ ਨਾਲ ਇੱਕ ਤਾਂ ਇਸ ਦੀ ਹਰ ਰੋਜ਼ ਕੀਮਤ ਵਧ ਵਧਦੀ ਜਾ ਰਹੀ ਹੈ ਅਤੇ ਇਸ ਨਾਲ ਹਰ ਟਾਈਮ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ